ਹੈਲੋ ਮੇਰਾ ਨਾਮ ਅਰੁਨਾ ਹੈ ਮੈਂ ਨਾ ਘਰ ਦੇ ਵਿੱਚ ਬਗ਼ੀਚੀ ਲਾਈ ਹੋਈ ਹੈ ਬੂਟੇ ਲਾਏ ਦੇ ਸਬਜ਼ੀਆਂ ਪੌਦੇ ਸਾਰਾ ਕੁਛ ਲਾਇਆ ਹੈ ਮੈਂ ਸਵੇਰੇ ਸ਼ਾਮੀਂ ਰੋਜ਼ ਪਾਣੀ ਦਿੰਦੀ ਹਾਂ ਅਤੇ ਉੱਥੇ ਪੰਛੀ ਵੀ ਆਉਂਦੇ ਹੈ ਜੰਗਲਾਂ ਦੇ ਵਿੱਚੋਂ ਅਤੇ ਉਹ ਨਾ ਮੈਂ ਉੱਤੇ ਨੈੱਟ ਵੀ ਲਾਈ ਹੋਈ ਹੈ ਨੈੱਟ ਲਾਈ ਦੀ ਹੈ ਅਤੇ ਉੱਥੇ ਬਜ਼ਾਰੋਂ ਘੋਂਸਲੇ ਮਿਲਦੇ ਹੈ ਰੈਡੀਮੇਟ ਉਹ ਲਿਆ ਕੇ ਮੈਂ ਲਾਏ ਹੈ ਪੰਛੀ ਆਉਂਦੇ ਹੈ ਉੱਥੇ ਬਹਿੰਦੇ ਹੈ ਸਵੇਰੇ ਸ਼ਾਮੀ ਮੈਂ ਪਾਣੀ ਵੀ ਉਨ੍ਹਾਂ ਨੂੰ ਦਿੰਦੀ ਹਾਂ ਚੋਲ ਪਾ ਦਿੰਦੀ ਹਾਂ ਕਣਕ ਪਾ ਦਿੰਦੀ ਹਾਂ ਦਲੀਆ ਜੋ ਵੀ ਮੇਰੇ ਕੋਲ ਹੁੰਦਾ ਮੈਂ ਉਨ੍ਹਾਂ ਨੂੰ ਦੇ ਦਿੰਦੀ ਹਾਂ ਉਹ ਆਉਂਦੇ ਹੈ ਅਤੇ ਖਾ ਕੇ ਅਤੇ ਘੋਂਸਲੇ 'ਚ ਬਹਿ ਜਾਂਦੇ ਹੈ ਸਵੇਰੇ ਸੁਵਖਤੇ ਉੱਠ ਕੇ ਮੈਂ ਉੱਤੇ ਨੈੱਟ ਵੀ ਲਾਈ ਹੋਈ ਹੈ ਉਨ੍ਹਾਂ ਦੇ ਛਾਂ ਕਰਨ ਨੂੰ ਵੀ ਉਹ ਉਨ੍ਹਾਂ ਨੂੰ ਧੁੱਪ ਨਾ ਲੱਗੇ ਬੜੀ ਧੁੱਪ ਹੈਗੀ ਹੈ ਗਰਮੀ 'ਚ ਬੈਠੇ ਰਹਿੰਦੇ ਹੈ ਉੱਥੇ ਆ ਕੇ ਅਤੇ ਸਵੇ ਸ਼ਾਮੀ ਵੀ ਪਾਣੀ ਦਿੰਦੀ ਹਾਂ ਸਵੇਰੇ ਵੀ ਸਬਜ਼ੀਆਂ ਲਾਈਆਂ ਵਿੱਚ ਸਬਜ਼ੀਆਂ ਦੇ ਵਿੱਚ ਉਹ ਮੈਂ ਉਹ ਜਿਹੜੇ ਦਵਾਈਆਂ ਮਿਲਦੀਆਂ ਉਹ ਵੀ ਪਾਉਂਦੀ ਹਾਂ ਵੀ ਕਿੰਨਾ ਨੇ ਕੀੜਾ ਨਾ ਲੱਗੇ ਅਤੇ ਬਾਕੀ ਉਨ੍ਹਾਂ ਦੇ ਜਾਨਵਰਾਂ ਨੂੰ ਮੈਂ ਸਾਰਾ ਕੁਛ ਕਿੰਨਾ ਨੂੰ ਹੀ ਕਰਦੀ ਹਾਂ ਉਨ੍ਹਾਂ ਨੂੰ ਪਾਣੀ ਸਵੇਰੇ ਸ਼ਾਮ ਅਤੇ ਉਹ ਆਉਂਦੇ ਹੈ ਸਵੇਰੇ ਬੜਾ ਮੈਨੂੰ ਚੰਗਾ ਲੱਗਦਾ ਮੈਨੂੰ ਸਕੂਨ ਮਿਲਦਾ ਅਰਾਮ ਲੱਗਦਾ ਵੀ ਲਓ ਪੰਛੀ ਆਉਂਦੇ ਹੈ ਮੇਰੇ ਘਰ ਦੇ ਵਿੱਚ ਬੋਲਦੇ ਹੈ ਅਤੇ ਉਹ ਬਹੁਤ ਚੰਗਾ ਲੱਗਦਾ ਵਾ ਮੈਨੂੰ ਬੜੀ ਮਨ ਨੂੰ ਤਸੱਲੀ ਹੁੰਦੀ ਹੈ ਵੀ ਚਲ ਮੈਂ ਬੂਟਿਆਂ ਦੀ ਸੇਵਾ ਕਰਦੀ ਹਾਂ ਅਤੇ ਪੰਛੀਆਂ ਦੀ ਵੀ ਕਰਦੀ ਹਾਂ ਅਤੇ ਉਨ੍ਹਾਂ ਦੇ ਨਾਲ ਨਾਲ ਮੈਂ ਘਰ ਦੇ ਵਿੱਚ ਕਿੰਨਾ ਨਹੀਂ ਬਹੁਤ ਸੋਹਣਾ ਕਿੰਨਾ ਨਹੀਂ ਕੀਤਾ ਹੋਇਆ ਵੀ ਸ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਪਾਣੀ ਸਵੇਰ ਸ਼ਾਮ ਰੋਜ਼ ਦਿੰਦੀ ਹਾਂ ਅਤੇ ਜਾਨਵਰਾਂ ਨੂੰ ਉਨ੍ਹਾਂ ਨੂੰ ਮੈਂ ਰੋਜ਼ ਕਿੰਨਾ ਨਹੀਂ ਉਹ ਪਾ ਕੇ ਆਉਂਨੀ ਹਾਂ ਦਲੀਆ ਕਦੀ ਕਣਕ ਕਦੀ ਚੋਲ ਪਾਣੀ ਦੋ ਤਿੰਨ ਟੈਮ ਮੈਂ ਪਾਣੀ ਜ਼ਰੂਰ ਰੱਖਦੀ ਹਾਂ